ਸਭ ਤੋਂ ਪਹਿਲਾਂ ਇਸ ਪ੍ਰਾਪਤੀ ਦੇ ਵਿੱਚ ਮੈਂ ਆਪਣੀ ਬੜੀ ਬੇਟੀ ਨੂੰ ਪੜ੍ਹਾ ਕੇ ਨੌਕਰੀ 'ਤੇ ਸੈੱਟ ਕਰਾਇਆ ਦੂਜਾ ਮੈਂ ਆਪਣੀ ਉਸ ਤੋਂ ਛੋਟੀ ਬੇਟੀ ਨੂੰ ਪੜ੍ਹਾ ਕੇ ਲਿਖਾ ਕੇ ਨੌਕਰੀ 'ਤੇ ਸੈੱਟ ਕਰਾਇਆ ਤੀਜੇ ਮੈਂ ਆਪਣੇ ਬੇਟੇ ਨੂੰ ਤਕਰੀਬਨ ਸੈਟੇ ਹੈ ਉਹ ਵੀ ਉਸ ਨੂੰ ਵੀ ਸੈੱਟ ਕਰਾਇਆ ਹੈ ਅਤੇ ਇਸ ਪ੍ਰਾਪਤੀਆਂ ਦੇ ਲਈ ਮੈਨੂੰ ਵੱਧ ਤੋਂ ਵੱਧ ਮਹਿਸੂਸ ਕਰਦਾ ਹੈ ਅਤੇ ਮੈਨੂੰ ਮਾਣ ਹੈ